ਸੱਭਿਆਚਾਰ ਜੋ ਹਰ ਇੱਕ ਸੱਭਿਆਚਾਰ ਹੈ ਉਹਦੇ ਜਿਹੜੇ ਹੈ ਕੁਛ ਨਾ ਕੁਛ ਬੰਦਿਸ਼ਾਂ ਵੀ ਹੁੰਦੀਆਂ ਨੇ ਸੱਭਿਆਚਾਰ ਬੜਾ ਖੁੱਲ੍ਹਾ ਹੁੰਦਾ ਵੈਸੇ ਮਨੁੱਖ ਦੇ ਲਈ ਸੱਭਿਆਚਾਰ ਦਾ ਕਲਚਰ ਹੈ ਉਹਦੇ ਰੀਤੀ ਰਿਵਾਜ਼ ਉਹਨਾਂ ਦਾ ਪਹਿਰਾਵਾ ਹੈ ਉਹਦੀ ਬੋਲ ਚਾਲ ਹੈ ਉਹਦੀ ਬੋਲੀ ਹੈ ਭਾਸ਼ਾ ਸਾਰਾ ਕੁਛ ਸੱਭਿਆਚਾਰ ਦੇ ਵਿੱਚ ਆ ਜਾਂਦਾ ਬਟ ਸਭਿਆਚਾਰ ਦੇ ਕੁਛ ਬੰਦਿਸ਼ਾਂ ਵੀ ਹੁੰਦੀਆਂ ਨੇ ਜਿਹਦੇ ਬੰਦਿਸ਼ਾਂ ਤੋਂ ਬਾਹਰ ਕੋਈ ਜੇਕਰ ਮਨੁੱਖ ਸਮਾਜ ਦਾ ਪ੍ਰਾਣੀ ਬਾਹਰ ਜਾਂਦਾ ਗਾ ਤਾਂ ਉਸ ਦੇ ਬੰਦਿਸ਼ਾਂ ਤੋਂ ਬਾਹਰ ਜਾਣ ਕਰਕੇ ਉਹਨੂੰ ਕੁਛ ਸਜਾਵਾਂ ਵੀ ਮਿਲਦੀਆਂ ਨੇ ਉਹ ਸੱਭਿਆਚਾਰ ਦੇ ਵਿੱਚ ਰਹਿਣ ਵਾਲੀ ਸੋਸਾਇਟੀ ਵੱਲੋਂ ਲੋਕਾਂ ਵੱਲੋਂ ਸਮਾਜ ਵੱਲੋਂ ਤਾਂ ਜਿਵੇਂ ਮੈਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਾਂ ਤਾਂ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਵੀ ਕੁਛ ਇੱਦਾਂ ਦੀਆਂ ਬੰਦਿਸ਼ਾਂ ਨੇ ਕੁਛ ਇੱਦਾਂ ਦੇ ਨਿਯਮ ਬਣੇ ਹੋਏ ਨੇ ਜਿਹੜੇ ਕਿ ਉੱਥੋਂ ਦੇ ਵਸਨੀਕ ਜਿਹੜੇ ਹੈਗੇ ਨੇ ਉਹਨੂੰ ਫੋਲੋ ਕਰਦੇ ਨੇ ਅਤੇ ਜੇਕਰ ਕੋਈ ਉਹਦਾ ਫੋਲੋ ਨਹੀਂ ਕਰਦਾ ਗਾ ਉਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਗਾ ਸੱਭਿਆਚਾਰ ਦੇ ਨਿਯਮ ਉਲੰਘਣਾ ਕਰਦਾ ਗਾ ਤਾਂ ਉਹਦੀਆਂ ਕੁਛ ਉੱਦਾਂ ਦੇ ਬੰਦਿਸ਼ਾਂ ਨੂੰ ਉਲੰਘਣਾ ਕਰਨ ਤੋਂ ਬਾਅਦ ਕੋਈ ਸਜਾਵਾਂ ਮਿਲਦੀਆਂ ਨੇ ਤਾਂ ਜਿਵੇਂ ਬੰਦਿਸ਼ਾਂ ਦੀ ਗੱਲ ਕਰਾਂ ਤਾਂ ਜਿਵੇਂ ਪੰਜਾਬ ਦੇ ਰਿਗਾਡਿੰਗ ਗੱਲ ਕਰਾਂ ਥੋੜ੍ਹੇ ਆਪਣੇ ਰਿਲੀਜੀਅਸ ਪਲੇਸਿਸ ਨੇ ਜਿਵੇਂ ਗੁਰਦੁਆਰਾ ਆ ਗਿਆ ਮੰਦਰ ਆ ਗਿਆ ਉਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਆਪਾਂ ਜੋ ਵੀ ਉੱਥੇ ਧਾਰਮਿਕ ਲੋਕ ਜਾਂਦੇ ਨੇ ਮੱਥਾ ਟੇਕਣ ਪੂਜਾ ਕਰਨੇ ਤੋਂ ਜ਼ਿਆਦਾਤਰ ਉਹਨਾਂ ਲਈ ਇੱਕ ਨਿਯਮ ਬਣਿਆ ਹੋਇਆ ਵੀ ਉਹਨਾਂ ਨੇ ਆਪਣਾ ਸਿਰ ਢੱਕ ਕੇ ਹੀ ਅੰਦਰ ਜਾਣਾ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਅੰਦਰ ਤਾਂ ਹਰ ਇੱਕ ਨੇ ਪੱਗ ਨਾਲ ਚੁੰਨੀ ਨਾਲ ਕੱਪੜੇ ਨਾਲ ਰੁਮਾਲ ਨਾਲ ਆਪਣਾ ਜਿਹੜਾ ਹੈ ਸਿਰ ਢੱਕ ਕੇ ਜਾਣਾ ਅਤੇ ਜਿਹੜੇ ਪੈਰਾਂ ਦੇ ਵਿੱਚ ਜੁਰਾਬਾਂ ਜਿਹੜੀਆਂ ਹੈਗੀਆਂ ਨੇ ਬੂਟ ਜੁਰਾਬਾਂ ਚੱਪਲਾਂ ਉਹ ਉਤਾਰ ਕੇ ਬਾਹਰ ਉਤਾਰ ਕੇ ਅੰਦਰ ਜਾਣਾ ਗਾ ਅਤੇ ਉੱਥੋਂ ਦਾ ਇੱਕ ਨਿਯਮ ਬਣਿਆ ਹੋਇਆ ਜੇ ਉਹਨੂੰ ਕੋਈ ਨਹੀਂ ਫੋਲੋ ਕਰਦਾ ਤਾਂ ਉਸ ਤਰੀਕੇ ਦੀ ਉਹਨਾਂ 'ਤੇ ਜਿਹੜੀ ਹੈਗੀ ਨਿਯਮ ਦੇ ਅਕੋਡਿੰਗ ਉੱਦਾਂ ਦੀ ਉਹਨਾਂ 'ਤੇ ਕਾਰਵਾਈ ਕੀਤੀ ਆ ਇਸ ਤਰੀਕੇ ਨਾਲ ਜੇ ਆਪਾਂ ਮੰਦਰ ਦੀ ਗੱਲ ਕਰੀਏ ਤਾਂ ਉੱਥੇ ਜੇ ਕਿਸੇ ਜਿਹੜੀ ਇਹ ਹੈ ਲੇਡੀਜ ਨੂੰ ਪੀਰੀਅਡਸ ਆਏ ਹੋਏ ਨੇ ਡੇਟਸ ਆਈਆਂ ਹੋਈਆਂ ਨੇ ਤਾਂ ਉਹ ਜਿਹੜੀ ਹੈਗੀ ਆ ਮੰਦਰ ਦੇ ਵਿੱਚ ਜਾ ਕੇ ਪੂਜਾ ਨਹੀਂ ਕਰ ਸਕਦੀ ਗੀ ਜੇਕਰ ਉਸ ਤਰੀਕੇ ਦੀ ਉਹ ਕਰਦੀ ਆ ਤਾਂ ਓਹ ਉੱਥੋਂ ਦੇ ਜਿਹੜੀ ਹੈਗੇ ਆ ਮੰਦਰ ਦੇ ਅਕੋਡਿੰਗ ਜੋ ਵੀ ਉਹਨਾਂ ਦਾ ਰੂਲ ਹੈ ਉਹਨੂੰ ਭੰਗ ਕਰਨ ਵਾਲੇ ਦੇ ਵਿਰੁੱਧ ਉਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਆ ਤਾਂ ਇਸ ਤਰੀਕੇ ਨਾਲ ਜਿਹੜੇ ਹੈਗੇ ਆ ਹਰ ਇੱਕ ਜਿਹੜੇ ਹੈਗੇ ਆ ਸੱਭਿਆਚਾਰ ਦੇ ਕੁਛ ਨਿਯਮ ਨੇ ਅਤੇ ਉਹ ਨਿਯਮਾਂ ਨੂੰ ਜਿਹੜਾ ਹੈ ਫੋਲੋ ਕਰਨਾ ਬਣਦਾ ਨਾ ਫੋਲੋ ਕਰਨ ਵਾਲੇ ਨੂੰ ਜਿਹੜਾ ਹੈ ਉਹਦੇ ਉਲੰਘਣਾ ਕਰਨ ਵਾਲੇ ਉਹਦੀ ਸਜ਼ਾ ਦਿੱਤੀ ਜਾਂਦੀ ਹੈ